ਮੈਂ ਦੇਸਰਾਜ ਬੋਲਦਾ ਹਾਂ ਪਿੰਡ ਭੂਲਚੱਕ ਢੇਸੀਆਂ ਤੋਂ ਰਹਿਣ ਵਾਲਾ ਪਠਾਨਕੋਟ ਦਾ ਹਾਂ ਮੇਰਾ ਇੱਕ ਦੋਸਤ ਹੈ ਅੰਬਰਸਰ ਤੋਂ ਪਠਾਨਕੋਟ ਆਏ ਲਿਆਉਣਾ ਚਾਹੁੰਦੇ ਹਾਂ ਉਹ ਪਰ ਬਸਟ ਬੱਸ ਸਟੈਂਡ ਹੈ ਉਹਦੇ ਵਾਸਤੇ ਇੱਕ ਗੱਡੀ ਬੁਕਿੰਗ ਕਰਵਾਉਣੀ ਹੈ ਵਧੀਆ ਜਿਹੀ ਸਾਫ਼ ਸੁਥਰੀ ਔਰ ਉਹਦੇ ਵਾਸਤੇ ਗੱਡੀ ਆ ਜਿਹੜੀ ਕੋਈ ਕੋਈ ਬਾਰੀ ਕੋਈ ਖਿੜਕੀ ਨਹੀਂ ਟੁੱਟੀ ਹੋਣੀ ਚਾਹੀਦੀ ਨਸ਼ ਡਰਾਈਵਰ ਕੋਈ ਨਸ਼ੇੜੀ ਨਹੀਂ ਹੋਣਾ ਚਾਹੀਦਾ ਪਰ ਵਧੀਆ ਇਮਾਨਦਾਰ ਹੋਣਾ ਚਾਹੀਦਾ ਹੈ ਜਿਹੜਾ ਜਿਹੜਾ ਮੇਰੇ ਦੋਸਤ ਨੂੰ ਆਪਣੇ ਪਠਾਨਕੋਟ ਪੁਜਾ ਸਕੇ ਰਾਹ 'ਚ ਰੋਕਣ ਵਾਸਤੇ ਉਹਨੂੰ ਵਧੀਆ ਜਿਹੀ ਕੋਈ ਰੈਸਟੋਰੈਂਟ 'ਤੇ ਖਾਣਾ ਖਾਣ ਤਾਈਂ ਕੋਈ ਵੱਧ ਤੋਂ ਵੱਧ ਖ਼ਰਚਾ ਵੀ ਹੋ ਸਕੇ ਇਸ ਕਰਕੇ ਉਹਦਾ ਪੰਜ ਹਜ਼ਾਰ ਰੁਪਇਆ ਬਜਟ ਆ ਸਕੇ